ਜੀ ਹਾਂ ਮੈਂ ਬਾਈਕਿੰਗ ਦੌਰਾਨ ਇੱਕ ਵਿਅਕਤੀ ਨੂੰ ਲਿਫਟ ਦਿੱਤੀ ਹੋਈ ਹੈ ਅਤੇ ਉਹ ਕਾਫੀ ਬਜ਼ੁਰਗ ਸਨ ਇਸ ਲਈ ਮੈਨੂੰ ਉਹਨਾਂ ਤੇ ਤਰਸ ਆ ਗਿਆ ਅਤੇ ਮੈਂ ਉਹਨਾਂ ਨੂੰ ਬਾਈਕਿੰਗ ਦੌਰਾਨ ਲਿਫਟ ਦਿੱਤੀ ਉਹ ਕਾਫੀ ਬਜ਼ੁਰਗ ਸਨ ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰਨ ਆਏ ਸਨ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਮੁੰਡਾ ਉਹਨਾਂ ਨੂੰ ਇੱਥੇ ਛੱਡ ਕੇ ਅਤੇ ਅੱਗੇ ਕਿਸੇ ਹੋਰ ਕੰਮ ਲਈ ਚਲਾ ਗਿਆ ਹੈ ਪਰ ਉਹ ਇੱਥੋਂ ਜਲਦੀ ਵਿਹਲੇ ਹੋ ਗਏ ਹਨ ਅਤੇ ਉਹ ਇਥੋਂ ਜਾਣਾ ਚਾਹੁੰਦੇ ਹਨ ਇਸ ਲਈ ਉਹ ਲਿਫਟ ਲੈ ਲੈਣ ਲਈ ਖੜੇ ਸਨ ਮੈਂ ਉਹਨਾਂ ਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅਸੀਂ ਕਈ ਗੱਲਾਂ ਕੀਤੀਆਂ ਜਿਵੇਂ ਕਿ ਉਹ ਕਾਫੀ ਬਜ਼ੁਰਗ ਸਨ ਇਸ ਲਈ ਮੈਨੂੰ ਉਹਨਾਂ ਤੋਂ ਕਾਫੀ ਗਿਆਨ ਮਿਲਿਆ ਅਤੇ ਉਹਨਾਂ ਨੇ ਮੈਨੂੰ ਮੇਰੀ ਪ੍ਰੀਖਿਆ ਬਾਰੇ ਪੁੱਛਿਆ ਹੈ ਅਤੇ ਇਸ ਤੋਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਵੀ ਛੱਡ ਕੇ ਆਇਆ ਉਹ ਕਾਫੀ ਬਜੁਰਗ ਸਨ ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਪੂਰੇ ਗੇਟ ਤੱਕ ਛੱਡ ਕੇ ਆਇਆ ਸੀ